ਪੰਜਾਬ ਵਿੱਚ ਟੈਕਨੋਲਜੀ ਦੇ ਖੇਤਰ ਅਤੇ ਨਵੀਨਤਾ ਅਤੇ ਸੁਝਣਾਤਮਕਤਾ ਨੂੰ ਸਾਹਿਤ ਕਰਨ ਵਿੱਚ ਇੰਟਰਨੈੱਟ ਬਹੁਤ ਮਦਦ ਕਰਤਾ ਹੈ ਇੰਟਰਨੈੱਟ ਦੀ ਮਦਦ ਦੇ ਨਾਲ ਅਸੀਂ ਕਿਸ ਵੀ ਖੇਤਰ ਵਿੱਚ ਤਰੱਕੀ ਕਰ ਸਕਦੇ ਹਾਂ ਪਰ ਇੰਟਰਨੈੱਟ ਦੀ ਮਦਦ ਦੇ ਨਾਲ ਇਹ ਵੀ ਜਾਣ ਸਕਦੇ ਹਾਂ ਕਿ ਸਾਨੂੰ ਕਿਹੜੀ ਟਕਨੋਲਜੀ ਵਧੀਆ ਹੈ ਅਤੇ ਕਿਹੜੀ ਨਹੀਂ ਵਧੀਆ ਹੈ ਇਸ ਦੇ ਨਾਲ ਅਸੀਂ ਆਪਣਾ ਕਿਹੜਾ ਵੀ ਡਾਟੇ ਦੀ ਰਿਸਰਚ ਕੀਤੀ ਹੁੰਦੀ ਹੈ ਉਸ ਨੂੰ ਆਪਾਂ ਗੂਗਲ ਉੱਤੇ ਪਾ ਕੇ ਸਭ ਕੁਛ ਜਾਣ ਸਕਦੇ ਹਾਂ ਕਿ ਸਾਡਾ ਕੰਮ ਸਹੀ ਹੋਇਆ ਹੈ ਜਾਂ ਨਹੀਂ ਪਰ ਇਸ ਦੇ ਨਾਲ ਅਸੀਂ ਇਹ ਵੀ ਕਰ ਸਕਦੇ ਹਾਂ ਕਿ ਆਪਾਂ ਨਮ ਇੰਟਰਨੈੱਟ ਦੀ ਮਦਦ ਦੇ ਨਾਲ ਨਵੀਂ ਟੈਕਨੋਲਜੀ ਵੀ ਲਿਆ ਸਕਦੇ ਹਾਂ ਗੂਗਲ ਤੋਂ ਅਸੀਂ ਇਹ ਜਾਣ ਸਕਦੇ ਹਾਂ ਕਿ ਸਾਨੂੰ ਇਸ ਸਮੇਂ ਕਿਹੜੀ ਟਕਨੋਲਜੀ ਦੀ ਜ਼ਰੂਰਤ ਹੈ ਪਰ ਅੱਜ ਦੇ ਯੁੱਗ ਵਿੱਚ ਤਾਂ ਮੋਬਾਈਲ ਫੋਨ ਦੀ ਹੀ ਜ਼ਿਆਦਾ ਜ਼ਰੂਰਤ ਬਣੀ ਹੋਈ ਹੈ ਕੀ ਹਾਂ ਵੀ ਇਹ ਬਹੁਤ ਜ਼ਰੂਰੀ ਹਨ ਜਿਸ ਕਾਰਨ ਅਸੀਂ ਆਪਣੀ ਐਫੀਸ਼ੀਐਂਸੀ ਨੂੰ ਵੀ ਵਧਾ ਸਕਦੇ ਹਾਂ ਇੰਟਰਨੈੱਟ ਦੀ ਮਦਦ ਦੇ ਨਾਲ਼ ਆਪਾਂ ਆਪਣੀ ਕੰਮ ਦੀ ਐਫੀਸ਼ੀਐਂਸੀ ਨੂੰ ਵਧਾ ਸਕਦੇ ਹਾਂ ਅਤੇ ਕੰਮ ਨੂੰ ਵਧੀਆ ਤਰੀਕੇ ਨਾਲ਼ ਕਿਸੇ ਦੂਸਰੇ ਦੇ ਸਾਹਮਣੇ ਵੀ ਦੱਸ ਸਕਦੇ ਹਾਂ ਕੀ ਕੰਮ ਕਿਹੜਾ ਵਧੀਆ ਤਰੀਕੇ ਨਾਲ਼ ਹੋ ਸਕਦਾ ਹੈ ਪਰ ਆਪਾਂ ਐਕਸਲ ਦੀ ਮਦਦ ਦੇ ਵਿੱਚ ਆਪਾਂ ਆਪਣਾ ਡਾਟਾ ਪਾ ਕੇ ਆਪਾਂ ਨਾ ਡਾਟੇ ਨੂੰ ਕੰਪਾਇਲ ਵੀ ਕਰਦੇ ਹਾਂ ਤਾਂ ਜੋ ਦੱਸ ਸਕੀਏ ਕੀ ਹਾਂ ਵੀ ਕਿ ਡਾਟਾ ਇਹ ਠੀਕ ਹੈ ਜਾਂ ਨਹੀਂ ਪਰ ਡਾਟੇ ਦੀ ਮਦਦ ਦੇ ਨਾਲ਼ ਅਸੀਂ ਐਕਸਲ ਦੀ ਮਦਦ ਦੇ ਨਾਲ ਅਸੀਂ ਆਪਣੇ ਜਮ ਡਾ ਕਿਸੇ ਕੰਪਨੀ ਦੇ ਵਧਾਅ ਅਤੇ ਅਤੇ ਚੜ੍ਹਾਅ ਨੂੰ ਦੱਸ ਸਕਦੇ ਹਾਂ ਕਿ ਕੰਪਨੀ ਪ੍ਰੋ ਲਾਭ ਵਿੱਚ ਜਾ ਰਹੀ ਹੈ ਜਾਂ ਹਾਨੀ ਵਿੱਚ ਇਹ ਸਾਡੀ ਇੰਟਰਨੈੱਟ ਦੀ ਮਦਦ ਦੇ ਨਾਲ਼ ਆਪਾਂ ਇਹ ਵੀ ਖੋਜ ਸਕਦੇ ਹਾਂ ਕੀ ਹਾਂ ਵੀ ਇਹ ਬੌਧਿਕ ਵਿਕਾਸ ਜਾਇਦਾਦ ਦੇ ਬਾਰੇ ਜਾਣਕਾਰੀ ਪਤਾ ਕਰਨੀ ਹੋਏ ਕੀ ਹਾਂ ਇਹ ਜਾਇਦਾਦ ਕਿਸ ਦੇ ਨਾਂ ਹੈ ਅਤੇ ਕਿਸ ਦੇ ਨਾਂ ਨਹੀਂ ਇਸ ਗੂਗਲ ਦੀ ਮਦਦ ਤੋਂ ਆਪਾਂ ਇਹ ਜਾਣ ਸਕਦੇ ਹਾਂ ਬਿਲਕੁਲ ਇਹ ਸਾਡੀ ਵੋ ਸਰਚ ਤਕਨੋਲਜੀ ਇੰਟਰਨੈੱਟ ਦੀ ਤਕਨੋਲਜੀ ਸਾਡੇ ਵਿੱਚ ਕੰਮ ਵਿੱਚ ਬਹੁਤ ਮਦਦ ਕਰਦੀ ਹੈ